ਹਾਂਜੀ ਬਿਲਕੁਲ ਮੈਂ ਤੁਹਾਨੂੰ ਪੰਜਾਬੀ ਵਿੱਚ ਇਸ ਸਵਾਲ ਦਾ ਜਵਾਬ ਵਿਸਥਾਰ ਨਾਲ ਦਿੰਦੀ ਆਂ ਕਿ ਸਰਕਾਰ ਨੇ ਖੁਰਾਕ ਦੀ ਵੰਡ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ ਜਿਹਨਾਂ ਵਿੱਚ ਮੁੱਖ ਜਨਤਕ ਵੰਡ ਪ੍ਰਣਾਲੀ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਰਕਾਰ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ 'ਤੇ ਅਨਾਜ ਖੰਡ ਅਤੇ ਮਿੱਟੀ ਦੇ ਤੇਲ ਮੁਹੱਈਆ ਕਰਵਾਉਂਦੀ ਹੈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਦੇਸ਼ ਦੀ ਲਗਭਗ ਤਿਹਾਈ ਆਬਾਦੀ ਨੂੰ ਸਬਸਿਡੀ ਵਾਲਾ ਅਨਾਜ ਪ੍ਰਾਪਤ ਕਰਨ ਦਾ ਅਧਿਕਾਰ ਦਿੰਦੀ ਹੈ ਸਰਕਾਰ ਨੇ ਸਕੀਮਾਂ ਦੇ ਲਈ ਆਂਗਣਵਾੜੀ ਸੇਵਾਵਾਂ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਿਹਨਾਂ ਦਾ ਉਦੇਸ਼ ਬੱਚਿਆਂ ਨੂੰ ਔਰਤਾਂ ਨੂੰ ਪੋਸ਼ਣ ਪ੍ਰਦਾਨ ਕਰਨਾ ਹੈ ਪਰ ਇਹਨਾਂ ਸਾਰੀਆਂ ਨੀਤੀਆਂ ਅਤੇ ਸਹੂਲਤਾਂ ਬਾਵਜੂਦ ਵੀ ਸਰਕਾਰ ਦੇ ਖੁਰਾਕ ਸਹਾਇਤਾ ਕਾਰਜ ਕਰਮਾਂ ਲਈ ਕਈ ਸਮੱਸਿਆਵਾਂ ਹਨ ਸਭ ਤੋਂ ਵੱਡੀ ਸਮੱਸਿਆ ਭ੍ਰਿਸ਼ਟਾਚਾਰ ਕਈ ਵਾਰ ਸਸਤੇ ਭਾਅ 'ਤੇ ਮਿਲਣ ਵਾਲਾ ਅਨਾਜ ਗਰੀਬਾਂ ਤੱਕ ਪਹੁੰਚਣ ਦੀ ਬਜਾਏ ਕਾਲਾ ਬਜ਼ਾਰੀ ਵਿੱਚ ਵਿਕ ਜਾਂਦਾ ਹੈ ਇਸ ਤੋਂ ਇਲਾਵਾ ਕਈ ਵਾਰ ਅਨਾਜ ਦੀ ਗੁਣਵੱਤਾ ਵੀ ਵਧੀਆ ਨਹੀਂ ਹੁੰਦੀ ਅਤੇ ਕਈ ਪਰਿਵਾਰਾਂ ਨੂੰ ਸਮੇਂ ਸਿਰ ਅਨਾਜ ਵੀ ਨਹੀਂ ਮਿਲਦਾ ਜਿਸ ਕਾਰਨ ਭੁੱਖਮਰੀ ਦਾ ਸਾਹਮਣਾ ਕਰਨਾ ਪੈਂਦਾ ਇਸ ਤੋਂ ਇਲਾਵਾ ਕਈ ਵਾਰ ਗਰੀਬ ਪਰਿਵਾਰ ਆਪਣਾ ਰਾਸ਼ਨ ਲੈਣ ਲਈ ਲੰਬੀਆਂ ਲਾਈਨਾਂ 'ਚ ਖੜ੍ਹਾ ਹੋਣਾ ਪੈਂਦਾ ਹੈ ਓਨਾਂ ਰਾਸ਼ਨ ਲੈਣ ਲਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸਮੱਸਿਆ ਨੂੰ ਦੂਰ ਕਰਨ ਲਈ ਸਖਤ ਕਦਮ ਚੁੱਕਣੇ ਪੈਂਦੇ ਗਰੀਬ ਪਰਿਵਾਰ ਸਮੇਂ ਸੇ ਹੀ ਸਹੀ ਮਾਤਰਾ ਵਿੱਚ ਅਨਾਜ ਨਾ ਮਿਲਣ ਕਰਕੇ ਕਈ ਇਕਾਈ ਵਿੱਚ ਸਾਮ ਕਈ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਨੇ ਸਰਕਾਰ ਦੇਸ਼ ਵਿੱਚ ਭੁੱਖਮਰੀ ਅਤੇ ਕੁਪੋਸ਼ਨ ਨੂੰ ਦੂਰ ਕਰਨ ਲਈ ਕਈ ਪ੍ਰੋਗ ਪ੍ਰੋਗਰਾਮ ਨੀਤੀਆਂ ਲਾਗੂ ਕੀਤੀਆਂ ਹਨ ਇਹਨਾਂ 'ਚ ਕੁਝ ਇਸ ਤਰ੍ਹਾਂ ਜਨਤਕ ਦੀ ਵੰਡ ਪ੍ਰਣਾਲੀ ਇਹ ਸਭ ਤੋਂ ਵੱਧ ਪ੍ਰਣਾਲੀ ਹੈ ਖੁਰਾਕ ਸਹਾਇਤਾ ਯੋਜਨਾ ਇਸਨੂੰ ਸਰਕਾਰ ਗਰੀਬੀ ਰੇਖਾ ਹੇਠਾਂ ਤੋਂ ਰਹਿ ਰਹੇ ਪਰਿਵਾਰਾਂ ਨੂੰ ਸਬਸਿਡੀ ਵਾਲੇ ਭਾਰ ਦੇ ਨਾਲ ਜਾਨੀ ਕਿ ਕਣਕ ਚੌਲ ਮੁਹੱਈਆ ਕਰਵਾਉਂਦੀ ਹੈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਇਸ ਨੇ ਸੁਰੱਖਿਆ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਇਸ ਐਕਟ ਦੇ ਤਹਿਤ ਦੇਸ਼ ਦੀ ਲਗਭਗ ਦੋ ਤਿਹਾਈ ਆਬਾਦੀ ਨੂੰ ਸਬਸਿਡੀ ਵਾਲੇ ਭਾਅ ਦੇ ਨਾਸ਼ ਕਰਨ ਦਾ ਅਧਿਕਾਰ ਦੇ ਦਿੱਤਾ ਆਯੁਸ਼ਮਾਨ ਭਾਰਤ ਯੋਜਨਾ ਇਹ ਯੋਜਨਾ ਗਰੀਬ ਪਰਿਵਾਰ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਂਦੀ ਹੈ ਇਸ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਹਸਪਤਾਲ ਲਿਜਾਣ ਕਾਰਨ ਪੰਜ ਲੱਖ ਰੁਪਏ ਸੇਵਾਵਾਂ ਮੁਹੱਈਆ ਕਰਾਉਂਦੀ ਹੈ ਇਹ ਯੋਜਨਾ ਤੋਂ ਇਲਾਵਾ ਸਰਕਾਰ ਦੇ ਕਈ ਹੋਰ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ ਜਿਹਨਾਂ ਦਾ ਉਦੇਸ਼ ਗਰੀਬੀ ਅਤੇ ਕੁਪੋਸ਼ਣ ਨੂੰ ਦੂਰ ਕਰਨਾ ਹੈ ਪਰ ਇਹ ਸਾਰੀਆਂ ਕੋਸ਼ਿਸ਼ਾਂ ਬਾਵਜੂਦ ਵੀ ਜੇ ਭੁੱਖਮਰੀ ਅਤੇ ਇੱਕ ਕਪੋਸ਼ਨ ਇੱਕ ਵੱਡੀ ਸਮੱਸਿਆ ਹੈ ਇਸਦੇ ਲਈ ਕਈ ਕਾਰਨ ਹਨ ਜਿਵੇਂ ਕਿ ਗਰੀਬੀ ਬੇਰੁਜ਼ਗਾਰੀ ਅਨਪੜ੍ਹਤਾ ਅਤੇ ਜਾਗਰਤਾ ਦੀ ਘਾਟ ਸਰਕਾਰ ਨੂੰ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਯਤਨ ਦੀ ਜ਼ਰੂਰਤ ਹੈ